ਇੱਕ ਜਨਵਰੀ ਦੋ ਹਜ਼ਾਰ ਇੱਕੀ ਪੰਜ ਅਪ੍ਰੈਲ ਦੋ ਹਜ਼ਾਰ ਚੌਵੀ ਛੱਬੀ ਮਈ ਉੱਨੀ ਸੌ ਸਤਾਨਵੇਂ ਛੇ ਮਾਰਚ ਉੱਨੀ ਸੌ ਸਤਾਨਵੇਂ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ